ਸਭ ਤੋਂ ਮਾਣ ਵਾਲੀ ਪ੍ਰਾਪਤੀ ਤੋਂ ਸ਼ੁਰੂ ਤੋਂ ਲੈ ਕੇ ਪਹਿਲੀ ਕਲਾਸ ਤੋਂ ਲੈ ਕੇ ਹੁਣ ਤੱਕ ਹੁਣ ਦੀ ਪੜ੍ਹਾਈ ਤੱਕ ਸਾਰੀ ਪੂਰੀ ਕਲਾਸ ਵਿੱਚੋਂ ਫਸਟ ਆਉਣਾ ਅਤੇ ਦੂਜੀ ਗੱਲ ਵੀ ਜਿੰਨੀ ਵੀ ਮੈਂ ਹੁਣ ਤੱਕ ਕੰਪੀਟੀਸ਼ਨ 'ਚ ਪਾਰਟੀਸਪੇਟ ਕੀਤਾ ਉਹਨਾਂ 'ਚ ਕਦੇ ਹਾਰੀ ਨਹੀਂ ਉਹਨਾਂ 'ਚ ਹਰ ਵਾਰ ਫਸਟ ਪੁਜ਼ੀਸ਼ਨ ਲਈ ਆ ਜਾਂ ਸੈਕਿੰਡ ਜਾਂ ਥਰਡ ਲੇਕਿਨ ਕਦੇ ਵੀ ਹਾਰੀ ਨਹੀਂ ਹੈਗੀ ਇਹ ਮੇਰੇ ਲਈ ਸਭ ਤੋਂ ਜ਼ਿਆਦਾ ਮਾਣ ਵਾਲੀ ਪ੍ਰਾਪਤੀ ਮਤਲਬ ਪੂਰੀ ਜ਼ਿੰਦਗੀ ਹੀ ਬਹੁਤ ਮਾਣ ਵਾਲੀ ਪ੍ਰਾਪਤੀ ਹੀ ਹੈ ਮੇਰੀ